ਬੱਚਿਆਂ ਦੇ ਕੱਪੜੇ ਬਹੁਤ ਹੀ ਸੋਹਣੇ ਆ ਰਹੇ ਨੇ ਅੱਜ ਕੱਲ੍ਹ ਅਤੇ ਬੱਚਿਆਂ ਦੇ ਕੱਪੜਿਆਂ ਵਿੱਚ ਬਹੁਤ ਹੀ ਆ ਰੰਗ ਬਿਰੰਗੇ ਕੱਪੜੇ ਆਉਂਦੇ ਨੇ ਕਿਉਂਕਿ ਬੱਚੇ ਬੱਚਿਆਂ ਦੇ ਕੱਪੜਿਆਂ 'ਚ ਡਿਜ਼ਾਇਨਿੰਗ ਬਹੁਤ ਘੱਟ ਕੀਤੀ ਹੁੰਦੀ ਹੈ ਕਿਉਂਕਿ ਉਹਨਾਂ ਦਾ ਸਰੀਰ ਸੈਂਸਿਟਿਵ ਹੁੰਦਾ ਹੈ ਜਿਸ ਕਾਰਨ ਉਹਨਾਂ ਦੇ ਜ਼ਿਆਦਾ ਕਢਾਈ ਵਗੈਰਾ ਨਹੀਂ ਕੀਤੀ ਜਾਂਦੀ ਪਰ ਉਹਨਾਂ ਦਾ ਕੱਪੜਾ ਇੰਨਾਂ ਸੌਫਟ ਹੁੰਦਾ ਹੈ ਕੀ ਉਹਨਾਂ ਦੀ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਹੀ ਕੱਪੜਾ ਤਿਆਰ ਕੀਤਾ ਜਾਂਦਾ ਹੈ ਬੱਚਿਆਂ ਦੇ ਕੱਪੜਿਆਂ ਵਿੱਚ ਅੱਜ ਕੱਲ੍ਹ ਲਾਈਟਿੰਗ ਵੀ ਬਹੁਤ ਦੇਖਣ ਨੂੰ ਮਿਲਦੀ ਹੈ ਇੰਨੀ ਸੋਹਣੇ ਬੱਚਿਆਂ ਦੇ ਕਿਡਸ ਵੇਅਰ ਤਿਆਰ ਕੀਤੇ ਜਾਂਦੇ ਹੈ ਕਿ ਬੱਚੇ ਪਾ ਕੇ ਉਹਨਾਂ ਨੂੰ ਇੰਨੇ ਸੋਹਣੇ ਅਤੇ ਬਹੁਤ ਵਧੀਆ ਲੱਗਦੇ ਨੇ